ਪੰਜਾਬੀ ਭਾਸ਼ਾ ਸਭ ਤੋਂ ਸੋਹਣੀ ਭਾਸ਼ਾ ਜਿਹੜੀ ਕਿ ਮੈਨੂੰ ਲੱਗਦੀ ਆ ਪੰਜਾਬੀਆਂ ਨੂੰ ਸਾਰਿਆਂ ਨੂੰ ਹੀ ਲੱਗਦੀ ਹੈ ਪੰਜਾਬੀ ਭਾਸ਼ਾ ਦਾ ਜੇਕਰ ਅਸੀਂ ਇਤਿਹਾਸ ਦੀ ਗੱਲ ਕਰੀਏ ਤਾਂ ਤੀਜੇ ਪਾਤਸ਼ਾਹ ਨੇ ਲਿਪੀਬੱਧ ਕੀਤਾ ਇਹਨਾਂ ਨੂੰ ਤਾਂ ਉਸ ਤੋਂ ਹੀ ਇਹ ਚੱਲਦੀ ਆ ਰਹੀ ਆ ਗੁਰਮੁਖੀ ਭਾਸ਼ਾ ਕਹਿੰਦੇ ਆ ਗੁਰੂਆਂ ਦੇ ਮੁਖ ਤੋਂ ਇਹ ਭਾਸ਼ਾ ਆਈ ਹੈ ਅਤੇ ਇਸਦੇ ਪੈਂਤੀ ਅੱਖਰ ਨੇ ਕੁਛ ਸੱਸੇ ਬਿੰਦੀ ਲਾ ਕੇ ਅੱਖਰ ਨੇ ਅਤੇ ਸਭ ਤੋਂ ਸੋਹਣੀ ਭਾਸ਼ਾ ਹੈ ਇਸ ਭਾਸ਼ਾ ਦੇ ਵਿੱਚ ਇੱਕ ਹਰ ਇੱਕ ਸ਼ਬਦ ਹੈ ਹਰ ਇੱਕ ਚੀਜ਼ ਨੂੰ ਡਿਫਾਈਨ ਕਰਨ ਦੇ ਲਈ ਉਹਨੂੰ ਦੱਸਣ ਦੇ ਲਈ ਬੋਲਣ ਦੇ ਲਈ ਸ਼ਬਦ ਹੈ ਸ਼ਬਦਾਂ ਦੇ ਪੱਖੋਂ ਇਹ ਭਾਸ਼ਾ ਬੜੀ ਹੀ ਅਮੀਰ ਹੈ ਬਾਕੀ ਪੰਜਾਬੀ ਭਾਸ਼ਾ ਹੈ ਪੰਜਾਬੀ ਕਲਚਰ ਹੈ ਪੰਜਾਬੀ ਸੱਭਿਆਚਾਰ ਹੈ ਹਰ ਇੱਕ ਹੀ ਬੜਾ ਮਤਲਬ ਵਧੀਆ ਹੈ ਅਤੇ ਜਿਵੇਂ ਜਿਵੇਂ ਜਿੱਥੇ ਜਿੱਥੇ ਪੰਜਾਬੀ ਜਾਂਦੇ ਨੇ ਉੱਥੇ ਉੱਥੇ ਪੰਜਾਬੀ ਵਿਕਸਿਤ ਹੋ ਰਹੀ ਹੈ ਕਨੇਡਾ ਦੇ ਵਿੱਚ ਅਮਰੀਕਾ 'ਚ ਇੰਗਲੈਂਡ 'ਚ ਸਾਰੇ ਕਿਤੇ ਪੰਜਾਬੀ ਵੱਸ ਰਹੇ ਨੇ ਤਾਂ ਉਹ ਆਪਣੇ ਨਾਲ ਪੰਜਾਬੀ ਨੂੰ ਲੈ ਕੇ ਜਾ ਰਹੇ ਨੇ ਤਾਂ ਪੰਜਾਬੀ ਦੀਆਂ ਲੋਕ ਗੀਤ ਨੇ ਪੰਜਾਬੀ ਜੋ ਬੋਲੀਆਂ ਨੇ ਗਿੱਧਾ ਹੈ ਭੰਗੜਾ ਹੈ ਪੰਜਾਬੀ ਗਾਣੇ ਨੇ ਇਹ ਸਾਰਾ ਕੁਛ ਬੜਾ ਹੀ ਵਧੀਆ ਤਰੀਕੇ ਦੇ ਨਾਲ ਪ੍ਰਫੁਲਿਤ ਹੋ ਰਿਹਾ ਹੈ ਕਿਤੇ ਕਿਤੇ ਲੱਗਦਾ ਹੁੰਦਾ ਹੈ ਕਿ ਜੇ ਕੇ ਹੁਣ ਵਾਲਾ ਟਾਈਮ ਹੈ ਉਹ ਥੋੜ੍ਹਾ ਸਕੂਲਾਂ ਦੇ ਵਿੱਚ ਪੰਜਾਬੀ ਨੂੰ ਤੋਂ ਬਿਨਾ ਹਿੰਦੀ ਇੰਗਲਿਸ਼ ਜ਼ਿਆਦਾ ਕੰਪਲਸਰੀ ਕੀਤੀ ਹੋਈ ਆ ਫਾਈਨ ਵਗੈਰਾ ਹੋ ਜਾਂਦਾ ਬਟ ਉਹ ਚਲੋ ਚੱਲਦੀਆਂ ਰਹਿੰਦੀਆਂ ਨੇ ਟਾਈਮ ਦੀਆਂ ਪਰ ਪੰਜਾਬੀ ਕਹਿ ਦਿੰਦੇ ਆ ਖਤਮ ਹੋ ਜਾਵੇਗੀ ਪਰ ਇੱਦਾਂ ਦਾ ਕੁਛ ਨਹੀਂ ਹੈ ਪੰਜਾਬੀ ਭਾਸ਼ਾ ਨਾ ਕਦੇ ਖਤਮ ਹੋਣ ਮਤਲਬ ਐਦਾਂ ਦਾ ਕੁਛ ਹੈ ਨੀ ਡਰਨ ਵਾਲੀ ਗੱਲ ਨਹੀਂ ਪੰਜਾਬੀ ਕਦੇ ਵੀ ਨਹੀਂ ਖਤਮ ਹੋਏਗੀ ਜਿੰਨਾ ਟਾਈਮ ਪੰਜਾਬੀ ਰਹਿਣਗੇ ਪੰਜਾਬੀ ਭਾਸ਼ਾ ਸਾਡੇ ਨਾਲ ਨਾਲ ਚੱਲੇਗੀ